ਮੈਨੂੰ ਮਹਿੰਦੀ ਲਗਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਕ ਆ ਅਤੇ ਮੈਂ ਬਹੁਤ ਸਾਰੀਆਂ ਅਜਿਹੀਆਂ ਕੁੜੀਆਂ ਹਨ ਵਿਆਹ ਵਾਲੀਆਂ ਕੁੜੀਆਂ ਹਨ ਜਿਨ੍ਹਾਂ ਦੇ ਮਹਿੰਦੀ ਲਗਾਈ ਹੈ ਅਤੇ ਉਹ ਮੇਰੀ ਮਹਿੰਦੀ ਨੂੰ ਕਾਫੀ ਹੀ ਪਸੰਦ ਕਰਦੇ ਨੇ ਅਤੇ ਸਾਰੇ ਮੇਰੇ ਮਾਂ ਪਿਉ ਦੋਸਤ ਸਾਰਿਆਂ ਨੂੰ ਪਤਾ ਹੈ ਕਿ ਮੈਂ ਮਹਿੰਦੀ ਬਹੁਤ ਅੱਛੀ ਲਗਾਉਂਦੀ ਹੈ ਅਤੇ ਉਹ ਮੈਨੂੰ ਬਹੁਤ ਹੀ ਉਤਸ਼ਾਹਿਤ ਕਰਦੇ ਹਨ ਇਸ ਕਲਾਕਾਰੀ ਬਾਰੇ ਕਿ ਤੂੰ ਬਹੁਤ ਹੀ ਅੱਛੀ ਲਗਾਉਂਦੀ ਹੈ ਅਤੇ ਉਹ ਬਹੁਤ ਵਾਰ ਮੈਨੂੰ ਕਹਿੰਦੀਆਂ ਨੇ ਕਿ ਜਦ ਵੀ ਅਸੀਂ ਮਹਿੰਦੀ ਲਗਾਉਣੀ ਤਾਂ ਅਸੀਂ ਤੇਰੇ ਤੋਂ ਹੀ ਲਗਾਵਾਂਗੇ ਤਾਂ ਇਸ ਲਈ ਮੈਨੂੰ ਵਧੀਆ ਲੱਗਦਾ ਕਿ ਮੇਰੇ ਵਿੱਚ ਇੱਕ ਇਹ ਗੁਣ ਹੈ ਕਿ ਮੈਂ ਮਹਿੰਦੀ ਜੋ ਕਲਾਕਾਰੀ ਬਹੁਤ ਵਧੀਆ ਕਰਦੀ ਹਾਂ